ਪ੍ਰਿੰਟ ਮੀਡੀਆ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਲਿਖਤ ਵਿੱਚ ਹੁੰਦਾ ਹੈ ਇਹਨੂੰ ਅਸੀਂ ਸਿਰਫ਼ ਪੜ੍ਹ ਸਕਦੇ ਹਾਂ ਔਰ ਸੋਸ਼ਲ ਮੀਡੀਆ 'ਤੇ ਅ ਆਪਾਂ ਪੜ੍ਹ ਵੀ ਸਕ ਸੁਣ ਵੀ ਸਕਦੇ ਹਾਂ ਅਤੇ ਦੇਖ ਵੀ ਸਕਦੇ ਹਾਂ ਭਰੋਸਾ ਤਾਂ ਸਾਨੂੰ ਦੋਹਾਂ 'ਤੇ ਹੀ ਬਰਾਬਰ ਹੈ